ਸੰਗੀਤ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੈ ਇਹ ਤੋਂ ਸਾਨੂੰ ਬੜੇ ਹੀ ਲਾਭ ਹੁੰਦੇ ਹਨ ਇਨ੍ਹਾਂ ਦਾ ਸ਼ੋਂਕ ਮੇਰੇ ਦੇਵਰ ਸੰਗੀਤ ਦਾ ਬਹੁਤ ਮਾਹਿਰ ਪ੍ਰਿੰਸੀਪਲ ਏ ਉਨ੍ਹਾਂ ਕੋਲੋਂ ਸਾਡੇ ਸਾਰੇ ਪਰਿਵਾਰ ਨੂੰ ਸੰਗੀਤ ਵਿੱਚ ਬੋਲਣ ਦੀ ਬੜੀ ਆਦਤ ਹੈ ਬੜੀ ਆਦਤ ਹੈ ਸਾਨੂੰ ਅਭਿਆਸ ਹੋ ਗਿਆ ਹੈ ਕਿ ਅਸੀਂ ਵੀ ਸੰਗੀਤ ਦੇ ਨਾਲ ਰਲੀਏ ਅਤੇ ਅਸੀਂ ਵੀ ਜਿਹੜਾ ਗਲੇ ਨੂੰ ਤਰ ਰੱਖਣ ਵਾਸਤੇ ਗਰਮ ਪਾਣੀ ਪੀਂਦੇ ਹੈ ਜਾਂ ਛੋਟੀ ਇਲਾਚੀ ਦਾ ਮਿਸ਼ਰੀ ਦਾ ਉਪਯੋਗ ਕਰਦੇ ਹੈ ਉਹ ਸਾਡੇ ਉਸਦੇ ਨਾਲ ਸਾਡਾ ਗਲਾ ਬੜਾ ਹੀ ਠੀਕ ਰਹਿੰਦਾ ਹੈ ਅਸੀਂ ਸੰਗੀਤ ਦੇ ਬਾਰੇ ਇਹ ਕਹਿਣਾ ਚਾਹੁੰਦੇ ਹੈ ਕਿ ਇਸ ਦੇ ਵਿੱਚ ਸਾਡੇ ਗਲੇ ਦੇ ਵਾਸਤੇ ਸਾਨੂੰ ਕੋਈ ਮਸਾਲੇ ਵਾਲੀਆਂ ਚੀਜਾਂ ਨਹੀਂ ਖਾਣੀਆਂ ਚਾਹੀਦੀਆਂ ਅਤੇ ਸਾਡੇ ਗਲੇ ਵਾਸਤੇ ਕੋਈ ਮਸਾਲੇ ਵਾਲੀਆਂ ਚੀਜਾਂ ਨਹੀਂ ਖਾਣੀਆਂ ਚਾਹੀਦੀਆਂ ਜਿਵੇਂ ਕਿ ਲੂਣ ਮਿਰਚ ਆਪਾਂ ਲੈਂਦੇ ਨਹੀਂ ਬਹੁਤ ਘੱਟੋ ਘੱਟ ਖਾਣਾ ਚਾਹੀਦਾ ਫਿੱਕਾ ਫਿੱਕਾ ਖਾਣਾ ਚਾਹੀਦਾ ਹੈ ਜਿਸ ਦੇ ਨਾਲ ਸਾਡਾ ਗਲਾ ਠੀਕ ਰਹੇ ਅਤੇ ਸਾਨੂੰ ਅਭਿਆਸ ਬਣਿਆ ਰਹੇ ਸੰਗੀਤ ਦੇ ਵਿੱਚ ਬੋਲਣ ਦੀ ਸਾਨੂੰ ਸਾਰੀ ਜਗ੍ਹਾ 'ਤੇ ਸੰਗੀਤ ਬੋਲਣ ਦੀ ਬਹੁਤ ਹੀ ਆਦਤ ਹੈਗੀ ਹੈ ਪ੍ਰੈਕਟਿਸ ਬਹੁਤ ਕਰਦੇ ਅਸੀਂ